ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਇਕੱਤੀ ਅਕਤੂਬਰ ਉੱਨੀ ਸੌ ਚੁਰਾਸੀ ਇੱਕੀ ਜਨਵਰੀ ਉੱਨੀ ਸੌ ਅਠਾਨਵੇਂ ਬਾਈ ਅਗਸਤ ਉੱਨੀ ਸੌ ਨੜਿਨਵੇਂ ਤਿੰਨ ਜੁਲਾਈ ਦੋ ਹਜ਼ਾਰ ਤੇਈ